ਮੇਰੀ ਸਹੇਲੀ ਰਾਣੀ ਦੇ ਘਰ ਬੱਚਾ ਹੋਇਆ ਮੈਂ ਪੁੱਛਿਆ ਕਿ ਕਿਹੜੇ ਹੋਸਪੀਟਲ ਹੋਇਆ ਅਤੇ ਉਹ ਕਹਿੰਦੀ ਵੀ ਵੀ ਉਸ਼ਾ ਸਵਾਮੀ ਦੇ ਹੋਇਆ ਬੱਚਾ ਮੈਂ ਸੁਣਿਆ ਪੁੱਛਿਆ ਬਈ ਬੱਚੇ ਦੀ ਰਜਿਸਟੀਨ ਕਰਵਾਈ ਹੈ ਜਨਮ ਤਰੀਕ ਅਤੇ ਨਾਲ ਵੀ ਉਹਨਾਂ ਨੂੰ ਸਾਰਾ ਕਾਰਡ ਬਣਵਾਉਣਾ ਪੈਂਦਾ ਹੈ ਸਾਰਾ ਕਾਰਡ ਕੂਡ ਬਣਵਾਉਣਾ ਪੈਂਦਾ ਆਨਲਾਈਨ ਸਾਰਾ ਕੰਮ ਚੱਲਦਾ ਹੈ ਅਤੇ ਬੱਚੇ ਦਾ ਨਾਂ ਸਰਟੀਫਿਕੇਟ ਵਗੈਰਾ ਵੈਰੀਫਿਕੇਸ਼ਨ ਕਰਨੀ ਪੈਂਦੀ ਹੈ ਫਿਰ ਉਹਨਾਂ ਦੇ ਕਾਰਡ ਬਣਦਾ ਇਹ ਜ਼ਰੂਰ ਕਰਵਾਓ ਤੁਸੀਂ ਉਹ ਮੇਰੀ ਸਹਾਇਤਾ ਕਰਨ ਦੀ ਪੇਸ਼ਕਸ਼ ਸਾਰਾ ਕੁਛ ਆਨਲਾਈਨ ਉਹਨਾਂ ਦਾ ਡੇਟ ਓਫ ਬਰਥ ਸਾਰਾ ਕੁਛ ਲਿਖਵਾਉਣਾ ਪੈਂਦਾ ਤਾਂ ਕਿ ਵੀ ਉਹਨਾਂ ਨੂੰ ਕੱਲ੍ਹ ਨੂੰ ਪਤਾ ਲੱਗ ਸਕੇ